ਪਹਿਲਾਂ ਲੋਕ ਰੇਡੀਓ ਸੁਣਦੇ ਹੁੰਦੇ ਸਨ ਅਤੇ ਖਬਰਾਂ ਪੜ੍ਹਦੇ ਹੁੰਦੇ ਸਨ ਅਤੇ ਸਿਰਫ ਇੱਕ ਦੂਰਦਰਸ਼ਨ ਹੀ ਸੀ ਜਿੱਥੇ ਉਹ ਸਾਰੇ ਮੰਨੋਰੰਜਨ ਦੇ ਸਾਧਨ ਦੇਖਦੇ ਹੁੰਦੇ ਸਨ ਪਰ ਅੱਜ ਕੱਲ੍ਹ ਫੋਨਾਂ ਉੱਤੇ ਹੀ ਸਾਰੀ ਵੀਡਿਓਜ਼ ਅਤੇ ਸੀਰੀਅਲ ਦੇਖੇ ਜਾਂਦੇ ਹਨ ਪਰ ਅੱਜ ਕੱਲ੍ਹ ਦੇ ਸੀਰੀਅਲ ਜਮ੍ਹਾ ਹੀ ਬੇਕਾਰ ਹਨ ਉਨ੍ਹਾਂ ਵਿੱਚ ਕੋਈ ਗਿਆਨ ਦੀ ਗੱਲ ਨਹੀਂ ਨਹੀਂ ਹੈ ਅਤੇ ਬੱਚੇ ਵੀ ਬਹੁਤ ਜ਼ਿਆਦਾ ਵਿਗੜ ਜਾਂਦੇ ਹਨ ਅਤੇ ਜ਼ਿੱਦੀ ਬਣ ਜਾਂਦੇ ਹਨ ਜਿਵੇਂ ਉਹ ਸੀਰੀਅਲ ਟੀਵੀ ਦੇਖਦੇ ਹਨ ਉਹ ਵੀ ਓਦਾਂ ਦੀ ਚੀਜ਼ਾਂ ਦੀ ਮੰਗ ਕਰਨ ਲੱਗ ਜਾਂਦੇ ਹਨ ਪਹਿਲਾਂ ਦਾ ਸਮਾਂ ਠੀਕ ਸੀ ਜਿੱਥੇ ਦੂਰਦਰਸ਼ਨ ਵਿੱਚ ਪੜ੍ਹਾਈ ਦੇ ਸੰਬੰਧੀ ਜਾਣਕਾਰੀ ਮਿਲਦੀ ਹੁੰਦੀ ਸੀ ਅਤੇ ਖਬਰਾਂ ਵੀ ਸੁਣਨ ਨੂੰ ਮਿਲ ਜਾਂਦੀਆਂ ਹੁੰਦੀਆਂ ਸਨ